ਬ ਮੈਂ ਚਾਹੁੰਦਾ ਕਿ ਦਸ ਪੀਜ਼ਾ ਔਡਰ ਬੁੱਕ ਕਰ ਦਿਉ ਵੀਹ ਬਰਗਰ ਅਤੇ ਨਾਲ ਦੋ ਲੀਟਰ ਦੀਆਂ ਚਾਰ ਪੰਜ ਬੋਤਲਾਂ ਕਰ ਦਿਓ ਪੰਜ ਬੋਤਲਾਂ ਕਰ ਦਿਓ ਕੋਲਡ ਡਰਿੰਕ ਦੀਆਂ ਸੌ ਫਰੈਂਚ ਫ੍ਰਾਈਜ ਜੇ ਪੋਸੀਬਲ ਉਹ ਵੀ ਕਰ ਦਿਉ ਆਰਡਰ ਜਿਹੜਾ ਅਤੇ ਮੈਂ ਇੰਨਾ ਔਡਰ ਕਰਕੇ ਮੈਂ ਤੁਸੀਂ ਪੇਮੈਂਟ ਦੱਸ ਦਿਓ ਕਿੰਨੀ ਆ ਅਤੇ ਹਾਂ ਇੰਨਾ ਔਡਰ ਜਿਹੜਾ ਵੱਡਾ ਮੈਂ ਤੁਹਾਨੂੰ ਕੀਤਾ ਵਾ ਮੰਗ ਕੀਤੀ ਆ ਔਡਰ ਦੀ ਇਹਦੇ 'ਤੇ ਪਲੀਜ਼ ਛੂਟ ਵੀ ਦੱਸ ਦਿਓ ਕੋਈ ਕੂਪਨ ਵਗੈਰਾ ਕੋਈ ਜਿਵੇਂ ਦਾ ਕੋਈ ਛੂਟ ਹੈਗਾ ਆ ਛੂਟ ਹੈਗੀ ਆ ਕੋਈ ਜਾਂ ਕੋਈ ਉਹਦਾ ਪ੍ਰੋਮੋਕੋਡ ਜਾਰੀ ਕਰ ਦਿਓ ਕੀ ਆ ਪ੍ਰੋਮੋਕੋਡ ਸੋ ਮੈਂ ਜਿਹੜਾ ਔਨਲਾਈਨ ਤੁਹਾਨੂੰ ਪੇ ਕਰ ਦੂਗਾ ਇਹਦੇ ਸੋ ਪਲੀਜ਼ ਇੰਨਾ ਦੱਸੋ ਕਿ ਇਹਦੇ ਵਿੱਚ ਕੀ ਛੂਟ ਤੁਸੀਂ ਕਿੰਨੀ ਦਊਗੇ ਜਾਂ ਛੂਟ ਜਿਹੜੇ ਕੂਪਨ ਕੋਈ ਦਿਉ ਜਾਂ ਛੋਟ ਤਾਂ ਤੁਹਾਨੂੰ ਦੇਣੀ ਬਣਦੀ ਹੈ ਕਿਉਂਕਿ ਇੰਨਾ ਵੱਡਾ ਔਡਰ ਜਿਹੜਾ ਮੈਂ ਤੁਹਾਨੂੰ ਕੀਤਾ ਹੈਗਾ